ਮੇਰੇ ਕੋਲ ਜਿਹੜੀ ਜੁੱਤੇ ਆ ਉਹ ਕੈਂਪਸ ਦੇ ਆ ਮੈਂ ਉਹਨਾਂ ਨੂੰ ਪਾ ਕੇ ਹੀ ਰਨਿੰਗ ਕਰਦਾ ਅਤੇ ਵਰਕ 'ਤੇ ਵੀ ਜਾਂਦਾ ਅਤੇ ਮੈਂ ਉਹਦੇ ਵਿੱਚ ਬਹੁਤ ਰਿਲੈਕਸ ਫੀਲ ਕਰਦਾ ਅਤੇ ਮੈਨੂੰ ਬਹੁਤ ਵਧੀਆ ਲੱਗਦੇ ਆ ਪਾਉਣੇ ਅਤੇ ਬੜੇ ਹੀ ਕੰਫਰਟੇਬਲ ਬੂਟ ਆ ਅਤੇ ਮੇਰੇ ਕੋਲ ਕੋਈ ਖਾਸ ਖੇਡ ਖ਼ਾਤਰ ਕੋਈ ਕੱਪੜੇ ਨਹੀਂ ਹੈਗੇ ਅਤੇ ਮੈਂ ਕੁਛ ਵੀ ਕਰਨ ਲਈ ਜਿਹੜੇ ਵੀ ਕੱਪੜੇ ਪਾਉਂਦਾ ਮੈਂ ਉਹਦੇ ਵਿੱਚ ਕੰਫਰਟੇਬਲ ਏ ਫੀਲ ਕਰਦਾ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿਸ ਤਰ੍ਹਾਂ ਦੇ ਨੇ